ਅਤੇ ਇਸ ਨਾਲ ਬਿਮਾਰੀਆਂ ਲੱਗਣ ਦਾ ਵੀ ਬਹੁਤ ਖਤਰਾ ਰਹਿੰਦਾ ਸੀ ਪਰ ਹੁਣ ਇਹ ਸਭ ਕੁਝ ਬਿਲਕੁਲ ਘੱਟ ਗਿਆ ਹੈ ਕਿਉਂਕਿ ਹੁਣ ਹਰੇਕ ਦੇ ਘਰ ਘਰ ਵਿੱਚ ਲੈਟਰੀਨਾਂ ਬਣ ਚੁੱਕੀਆਂ ਹਨ ਅਤੇ ਬਹੁਤ ਵਿਕਾਸ ਹੋ ਚੁੱਕਾ ਹੈ